ਹਾਂਜੀ ਭਾਈ ਸਾਹਬ ਮੈਨੂੰ ਬਹੁਤ ਜਲਦੀ ਹੈਗੀ ਹੈ ਅਤੇ ਮੈਂ ਆਪਣੇ ਟਿਕਾਣੇ 'ਤੇ ਪਹੁੰਚਣਾ ਹੈਗਾ ਅਤੇ ਮੈਨੂੰ ਥੋੜ੍ਹਾ ਜਿਹਾ ਦੱਸੋ ਕਿੰਨਾ ਕੁ ਟਾਈਮ ਹੋਰ ਲੱਗੇਗਾ